ਹਾਂਜੀ ਮੇਰੀ ਜ਼ਿੰਦਗੀ ਦੇ ਵਿੱਚ ਉੱਨੀ ਸੌ ਤ੍ਰਿਆਨਵੇਂ ਵਿੱਚ ਇਹੋ ਜਿਹਾ ਹਾਦਸਾ ਵਾਪਰਿਆ ਜੋ ਕਿ ਨਾ ਭੁੱਲਣਯੋਗ ਹੈ ਉਸ ਸਮੇਂ ਮੇਰਾ ਮੰਗਣਾ ਹੋਇਆ ਵਾ ਸੀ ਅਤੇ ਉਸ ਸਮੇਂ ਬਹੁਤ ਹੀ ਮਾੜੇ ਹਾਲਾਤ ਸਨ ਮੀਂਹ ਮੀਂਹ ਕਾਰਨ ਹੜ੍ਹ ਆ ਗਏ ਸਨ ਪਟਿਆਲੇ ਵਿੱਚ ਉਨ੍ਹੀ ਸੌ ਤ੍ਰਿਆਨਵੇਂ ਵਿੱਚ ਕਿਉਂਕਿ ਹੜ੍ਹਾਂ ਦੇ ਕਾਰਨ ਸਾਡਾ ਸਾਰਾ ਸਮਾਨ ਭਿੱਜ ਗਿਆ ਅਤੇ ਘਰ ਵਿੱਚ ਪਾਣੀ ਵੜ ਗਿਆ ਸੀ ਨਦੀ ਵਿੱਚ ਪਾਣੀ ਆ ਗਿਆ ਅਤੇ ਪਾਣੀ ਸਾਰੇ ਪਟਿਆਲੇ ਵਿੱਚ ਵੜ੍ਹ ਗਿਆ ਸੀ ਅਤੇ ਸਾਡਾ ਸਾਰਾ ਸਮਾਨ ਖਰਾਬ ਹੋ ਗਿਆ ਮੇਰੇ ਦਾਜ ਦਹੇਜ ਵਾਲਾ ਵੀ ਸਾਰਾ ਸਮਾਨ ਖਰਾਬ ਹੋ ਗਿਆ ਜਿਸ ਕਰਕੇ ਸਾਨੂੰ ਬਹੁਤ ਮੁਸ਼ਕਿਲਾਂ ਦਾ ਔਕੜਾਂ ਦਾ ਸਾਹਮਣਾ ਕਰਨਾ ਪਿਆ ਅਤੇ ਸਾਡੇ ਸਾਰੇ ਬਿਸਤਰੇ ਕੱਪੜੇ ਲੀੜੇ ਸਭ ਗਿੱਲ੍ਹੇ ਹੋ ਗਏ ਖਾਣ ਵਾਸਤੇ ਰੋਟੀ ਨਹੀਂ ਰਹੀ ਭੁੱਖੇ ਥਿਹਾਏ ਅਸੀਂ ਕੋਠੇ 'ਤੇ ਬੈਠੇ ਉੱਪਰ ਚੜ੍ਹਾਇਆ ਸਮਾਨ ਮਾੜਾ ਮੋਟਾ ਜਿਸ ਕਰਕੇ ਸਾਨੂੰ ਭੁੱਖੇ ਰਹਿ ਕੇ ਵੀ ਰਾਤ ਗੁਜ਼ਾਰਨੀ ਪਈ ਅਤੇ ਥੱਲ੍ਹੇ ਚੋਰਾਂ ਨੇ ਟਾਇਰ ਪਾ ਪਾ ਕੇ ਜਿਹੜਾ ਮਾੜਾ ਮੋਟਾ ਸਮਾਨ ਬਚਿਆ ਖੁਚਿਆ ਸੀ ਉਹ ਵੀ ਲੈ ਗਏ ਅਤੇ ਸਾਡਾ ਸਾਡੇ ਮੱਝਾਂ ਮੱਝੀਆਂ ਗਾਵਾਂ ਸਾਰੀਆਂ ਪਾਣੀ ਵਿੱਚ ਹੜ੍ਹ ਗਈਆਂ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਸ ਕਰਕੇ ਸਾਡੀਆਂ ਕਣਕਾਂ ਵੀ ਖਰਾਬ ਹੋ ਗਈਆਂ ਕਣਕਾਂ ਖਰਾਬ ਹੋਣ ਦੇ ਕਾਰਨ ਸਾਰੇ ਪਟਿਆਲਾ ਸ਼ਹਿਰ ਦੇ ਵਿੱਚ ਮਹਾਮਾਰੀ ਫੈਲ ਗਈ ਬਦਬੂ ਉੱਠ ਗਈ ਗੰਦੀ ਸਮੈੱਲ ਆਉਣ ਨਾਲ ਮੱਝਾਂ ਗਾਵਾਂ ਦੇ ਨਾਲ ਬਦਬੂ ਉੱਠ ਕੇ ਮਹਾਮਾਰੀ ਫੈਲ ਗਈ ਬਿਮਾਰੀ ਫੈਲ ਗਈ ਜਿਸ ਕਰਕੇ ਬਹੁਤ ਔਕੜਾਂ ਮੁਸੀਬਤਾਂ ਦਾ ਸਾਨੂੰ ਸਾਹਮਣਾ ਕਰਨਾ ਪਿਆ ਅਤੇ